ਫੋਟੋਗ੍ਰਾਫੀ ਕਰਨਾ ਮੇਰਾ ਪਸੰਦੀਦਾ ਵਿਸ਼ਾ ਹੈ ਮੈਂ ਆਪਣੇ ਫਰੀ ਟਾਈਮ ਦੇ ਵਿੱਚ ਫੋਟੋਗ੍ਰਾਫੀ ਕਰਦੀ ਹਾਂ ਜੇ ਕੋਈ ਸ਼ੌਕ ਜਾਂ ਪੇਸ਼ੇ ਵਜੋਂ ਫੋਟੋਗ੍ਰਾਫੀ ਕਰਨਾ ਚਾਹੁੰਦਾ ਹੈ ਤਾਂ ਮੈਂ ਉਸਨੂੰ ਇਹੀ ਸਲਾਹ ਦਊਂਗੀ ਕਿ ਤੁਸੀਂ ਜਦੋਂ ਵੀ ਕੋਈ ਫੋਟੋ ਲੈਣ ਜਾਵੋ ਤਾਂ ਖੁੱਲ੍ਹੇ ਵਾਤਾਵਰਨ ਵਿੱਚ ਜਾਓ ਉੱਥੇ ਜਾਨਵਰਾਂ ਦਰੱਖਤਾਂ ਵੱਖ ਵੱਖ ਤਰ੍ਹਾਂ ਦੇ ਆਲੇ ਦੁਆਲੇ ਦੀਆਂ ਫੋਟੋਆਂ ਲਓ ਜਿੰਨਾ ਹੋ ਸਕੇ ਆਪਣੇ ਦਿਲੋਂ ਕੋਸ਼ਿਸ਼ ਕਰੋ ਵਧੀਆ ਫੋਟੋ ਲੈਣ ਦੀ ਜਿੰਨੇ ਵਧੀਆ ਮਨ ਨਾਲ ਅਸੀਂ ਜਾ ਕੇ ਫੋਟੋਆਂ ਖਿੱਚਾਂਗੇ ਓਨੀਆਂ ਹੀ ਉਹ ਲੋਕਾਂ ਨੂੰ ਪਸੰਦ ਆਉਣਗੀਆਂ ਜਿਸ ਨਾਲ ਦੇਖਣ ਵਾਲੇ ਨੂੰ ਵੀ ਸਕੂਨ ਮਿਲੇਗਾ ਕੁਦਰਤੀ ਫੋਟੋਆਂ ਹਰ ਇੱਕ ਦੀਆਂ ਅੱਖਾਂ ਨੂੰ ਸੋਹਣੀਆਂ ਲੱਗਦੀਆਂ ਹਨ ਜਿਵੇਂ ਕੁਦਰਤੀ ਝਰਨੇ ਜੇ ਉਹਨਾਂ ਦੀ ਵਧੀਆ ਫੋਟੋ ਲਈ ਜਾਵੇ ਤਾਂ ਉਹ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਹਨ ਇਸ ਨਾਲ ਹਰ ਇੱਕ ਦੇ ਮਨ ਨੂੰ ਸਕੂਨ ਮਿਲਦਾ ਹੈ